ਹਾਂਜੀ ਮੈਂ ਬਹੁਤ ਵਾਰ ਬਹੁਤ ਕੁਛ ਬਣਾਇਆ ਅਤੇ ਮੈਨੂੰ ਲਗਭਗ ਸਭ 'ਤੇ ਹੀ ਮਾਣ ਹੈ ਕਿਉਂਕਿ ਮਿਹਨਤ ਜੋ ਕਰੀ ਹੈ ਅਤੇ ਫਿਰ ਵੈਸੇ ਖਾਸ ਇੱਕ ਬਣਾਇਆ ਸੀ ਮੈਂ ਟੋਕਰੀ ਬਣਾਈ ਸੀ ਉਹਦੀ ਚਾਟ ਪੇਪਰਾਂ ਦੀ ਉਹ ਸੋਹਣੀ ਲੱਗਦੀ ਹੈ ਦੇਖਣੇ ਨੂੰ ਉਹ ਸ਼ੋਪੀਸ ਬਣ ਜਾਂਦਾ ਹੈ ਜਦੋਂ ਬਣਾਉਂਦੇ ਹਾਂ ਅਤੇ ਉਹ ਮੈਂ ਬਣਾਈ ਸੀ ਚਾਰਟ ਪੇਪਰਾਂ ਦੀ ਅਤੇ ਉਹਦਾ ਨੇਚੇ ਬੇਸ ਲਿਆ ਸੀ ਡਿਸਕ ਜੋ ਡਿਸਕ ਹੁੰਦੀ ਡੀਵੀਡੀ ਡਿਸਕ ਉਹ ਉਸ ਤੇ ਬਾਅਦ ਉਸਨੂੰ ਜੋ ਟੋਕਰੀ ਆ ਉਹਨੂੰ ਰਾਊਂ ਕੱਟ ਕੇ ਰਾਊਂਡ ਰਾਊਂਡ ਕਲਰਫੁੱਲ ਟੋਕਰੀ ਬਣਾਈ ਸੀ ਅਤੇ ਉਹ ਸ਼ੋਪੀਸ ਬਹੁਤ ਸੋਹਣਾ ਲੱਗਦਾ ਹੈ ਅਤੇ ਮੇਰੇ ਮਾਪੇ ਅਤੇ ਮੇਰੇ ਫਰੈਂਡ ਅਤੇ ਕਸਟਮਰ ਮੇਰੇ ਹੁਨਰ ਬਾਰੇ ਬਹੁਤ ਤਾਰੀਫਾਂ ਕਰਦੇ ਹਨ ਕਿ ਤੁਹਾਡੇ ਵਿੱਚ ਕ ਇਹ ਕਲਾ ਬਹੁਤ ਵਧੀਆ ਹੈ ਤੁਸੀਂ ਬਹੁਤ ਆਪਣੇ ਕੰਮ ਨੂੰ ਲੈ ਕੇ ਮੋਟੀਵੇਟ ਹੋ ਅਤੇ ਤੁਹਾਡਾ ਕੰਮ ਅੱਗੇ ਤੱਕ ਬਹੁਤ ਅੱਗੇ ਤੱਕ ਜਾਏਗਾ ਅਤੇ ਉਹ ਮੈਨੂੰ ਅਲੱਗ ਅਲੱਗ ਤਰੀਕੇ ਨਾਲ ਮੇਰੇ ਕੰਮ ਦੀ ਫੀਡਬੈਕ ਦਿੰਦੇ ਰਹਿੰਦੇ ਨੇ ਜਦੋਂ ਮੈਂ ਉਹਨਾਂ ਨੂੰ ਕੁਛ ਨਾ ਕੁਛ ਨਵਾਂ ਬਣਾ ਕੇ ਦਿੰਦੀ ਰਹਿੰਦੀ ਹਾਂ ਅਤੇ ਜਦੋਂ ਉਹਨਾਂ ਨੂੰ ਉਹ ਮੇਰੀ ਕਰੇ ਹੋਏ ਕੰਮ ਨੂੰ ਦੇਖਦੇ ਹਨ ਤਾਂ ਹਰ ਵਾਰ ਮੇਰੀ ਤਾਰੀਫ ਕਰਦੇ ਹਨ ਤਾਂ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਕੋਈ ਮੇਰੀ ਤਾਰੀਫ ਕਰਦਾ ਹੈ ਮੇਰੇ ਕੰਮ ਦੀ ਅਤੇ ਇਸੇ ਤਰ੍ਹਾਂ ਮੈਂ ਆਪਣੇ ਹੁਨਰ ਨੂੰ ਅਲੱਗ ਅਲੱਗ ਤਰੀਕੇ ਨਾਲ ਲੋਕਾਂ ਵਿੱਚ ਦਿਖਾਉਂਦੀ ਰਹਿੰਦੀ ਹਾਂ ਆਪਣੇ ਗਾਹਕਾਂ ਵਿੱਚ ਆਪਣੇ ਦੋਸਤਾਂ ਵਿੱਚ ਅਤੇ ਆਪਣੇ ਮਾਪਿਆਂ ਵਿੱਚ ਅਤੇ ਇੱਕ ਹੋਰ ਜਦੋਂ ਮੇਰੇ ਕਿਸੇ ਦੋਸਤ ਦਾ ਜਾਂ ਮੇਰੀ ਕਿਸੇ ਫੈਮਲੀ ਮੈਂਬਰ ਦਾ ਬਰਡੇ ਹੁੰਦਾ ਤਾਂ ਮੈਂ ਉਹਨਾਂ ਨੂੰ ਆਪਣੇ ਹੱਥਾਂ ਨਾਲ ਬਣਾ ਕੇ ਹੈਂਡ ਆਰਟ ਐਂਡ ਕਰਾਫਟ ਨਾਲ ਆਪਣੀ ਕਲਾ ਨਾਲ ਅਲੱਗ ਅਲੱਗ ਸ਼ੋਪੀਸ ਬਣਾ ਕੇ ਦਿੰਦੀ ਹਾਂ ਅਤੇ ਉਹ ਉਹਨੂੰ ਬਹੁਤ ਪਸੰਦ ਕਰਦੇ ਹਨ ਅਤੇ ਮੇਰੀ ਬਣਾਈ ਹੋਈ ਚੀਜ਼ ਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਹਨ ਅਤੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਕਿਸੇ ਨੂੰ ਮੇਰੇ ਕੰਮ ਦੀ ਬਹੁਤ ਜ਼ਿਆਦਾ ਮੇਰੀ ਕੰਮ ਦੀ ਤਾਰੀਫ ਕਰਦੇ ਹਨ ਅਤੇ ਉਹਨਾਂ ਨੂੰ ਮੇਰਾ ਕੰਮ ਕੀਤਾ ਹੋਇਆ ਪਸੰਦ ਆਉਂਦਾ ਹੈ